ਮੈਂ ਇੱਕ ਕਮਿਊਨਿਟੀ ਸਫ਼ਾਈ ਪ੍ਰੋਗਰਾਮ ਦੀ ਯੋਜਨਾ ਬਣਾ ਰਹੀ ਹਾਂ ਅਤੇ ਇਸ ਵਿੱਚ ਮੈਂ ਆਪਣੇ ਭਾਗੀਦਾਰਾਂ ਨੂੰ ਰੀਸਾਈਕਲਿੰਗ ਸਥਾਨਾਂ ਬਾਰੇ ਜਾਣਕਾਰੀ ਦੇਣੀ ਚਾਹੁੰਦੀ ਹਾਂ ਇਸ ਵਿੱਚ ਮੈਨੂੰ ਚਾਹੀਦਾ ਹੈ ਕਿ ਸਥਾਨਕ ਕੂੜਾ ਪ੍ਰਬੰਧਾਂ ਅਥੋਰਟੀ ਨਾਲ ਮੇਰਾ ਸੰਪਰਕ ਹੋਵੇ ਜਿਸ ਜਿਸ ਕਰਕੇ ਮੈਂ ਉਨ੍ਹਾਂ ਨੂੰ ਪੁੱਛ ਸਕਾਂ ਕਿ ਇੱਥੇ ਕਿਹੜੀਆਂ ਕਿਹੜੀਆਂ ਥਾਵਾਂ ਹਨ ਜਿੱਥੇ ਰੀਸਾਈਕਲ ਰੀਸਾਈਕਲਿੰਗ ਹੋ ਸਕੇ ਅਤੇ ਉੱਥੇ ਸਵੀਕਾਰਯੋਗ ਸਮੱਗਰੀ ਕੀ ਹੈ ਉੱਥੇ ਕੀ ਕੀ ਸਮਾਨ ਨਹੀਂ ਪਹੁੰਚਾਇਆ ਜਾ ਸਕਦਾ ਅਤੇ ਪੁਨਰ ਚੱਕਰਣ ਲਈ ਕਿਸੇ ਵਿਸ਼ੇਸ਼ ਜ਼ਰੂਰਤ ਬਾਰੇ ਵੀ ਮੈਂ ਜ਼ਰੂਰ ਪੁੱਛਾਂਗੀ ਧੰਨਵਾਦ